ਸਬਜ਼ੀਆਂ ਦੀ ਬਗੀਚੇ ਦੀ ਸਾਂਭ ਲਈ ਕੀੜਿਆਂ ਤੋਂ ਬਚਾਉਣ ਲਈ ਉਹਨਾਂ ਨੂੰ ਇਹ ਕੀੜੇਮਾਰ ਦਵਾਈਆਂ ਜਿਹੜੀਆਂ ਨਾਰਮਲ ਹੁੰਦੀਆਂ ਨੇ ਕਿ ਨੁਕਸਾਨ ਕਰਨ ਵਾਲੀਆਂ ਨਾ ਹੋਣ ਉਹਨਾਂ ਦੀ ਸਪਰੇਅ ਕੀਤੀ ਜਾਂਦੀ ਹੈ ਮੌਸਮ ਦੇ ਹਿਸਾਬ ਨਾਲ ਜਿਵੇਂ ਗਰਮੀਆਂ ਆ ਜਾਂਦੀਆਂ ਜੀ ਗਰਮੀਆਂ ਦੇ ਵਿੱਚ ਵੀ ਉਹਨਾਂ ਨੂੰ ਥੋੜ੍ਹਾ ਬਹੁਤਾ ਉੱਪਰ ਡੰਡੇ ਖੜ੍ਹੇ ਕਰਕੇ ਉੱਪਰ ਛੱਪਰ ਜਿਹਾ ਰੱਖਣਾ ਪੈਂਦਾ ਹੈ ਕਿ ਧੁੱਪ ਸੂਰਜ ਜਿਹਾ ਨਾ ਲੱਗੇ ਕਿ ਸਰਦੀਆਂ ਦੀ ਵੀ ਮੌਸਮ ਆਉਂਦੀ ਰਹਿੰਦੀ ਹੈ ਜੀ ਸਰਦੀਆਂ ਦੇ ਵਿੱਚ ਏ ਜਿਵੇਂ ਲਸਣ ਹੁੰਦਾ ਹੈ ਜੀ ਇਹ ਜਿਹੀਆਂ ਚੀਜ਼ਾਂ ਨੂੰ ਉੱਪਰ ਪਰਾਲ਼ੀ ਵਿਛਾ ਕੇ ਜੰਮਣ ਲਈ ਉਹਨਾਂ ਨੂੰ ਉਪਖਾਰਾ ਦੇਣਾ ਪੈਂਦਾ ਹੈ ਜੀ ਫਿਰ ਜਦੋਂ ਉਹਦੀਆਂ ਤੂਹੀਆਂ ਲਸਣ ਦੀਆਂ ਬਾਹਰ ਆ ਜਾਂਦੀਆਂ ਦਿਖਣ ਲੱਗ ਜਾਂਦੀਆਂ ਨੇ ਫੇਰ ਉਹ ਪਰਾਲ਼ੀ ਥੋੜ੍ਹਾ ਟਾਇਮ ਬਾਅਦ ਉਹਨੂੰ ਚੱਕ ਕੇ ਪਾਸੇ ਕਰ ਦਈ ਦਿੰਦੇ ਹਾਂ ਜਿਵੇਂ ਮੱਛਰ ਵਗੈਰਾ ਤੋਂ ਵੀ ਅਸੀਂ ਕਈ ਤਰ੍ਹਾਂ ਦੀਆਂ ਆਪ ਦਵਾਈਆਂ ਤਿਆਰ ਕਰਕੇ ਦੇਸੀ ਦਵਾਈਆਂ ਤਿਆਰ ਕਰਕੇ ਜਿਵੇਂ ਡੇਕ ਦੇ ਪੱਤੇ ਧਤੂਰੇ ਦਾ ਹੁੰਦਾ ਜੀ ਧਤੂਰਾ ਇੱਕ ਛੋਟਾ ਜਿਹਾ ਜੰਗਲਾਮ ਬ ਬੂਟਾ ਹੁੰਦਾ ਉਹਦੇ 'ਚ ਵੀ ਜ਼ਹਿਰ ਹੁੰਦੀ ਉਹ ਸਪਰੇਅ ਕਰਨ ਨਾਲ ਉਹਨਾਂ ਦੇ ਫੁੱਲਾਂ ਨੂੰ ਵੀ ਫਾਇਦਾ ਹੁੰਦਾ ਹੈ ਸਪਰੇਅ ਵਗੈਰਾ ਜਦੋਂ ਕਰਨੀ ਹੈ ਉਹ ਵੀ ਕਈ ਵਾਰੀ ਟਾਇਮ ਮੌਸਮ ਨੂੰ ਦੇਖ ਕੇ ਕਰਨਾ ਪੈਂਦਾ ਹੈ ਜੀ ਜਿਵੇਂ ਕਿ ਕੋਈ ਆਪਣੀ ਬ ਦੇਖਭਾਲ ਲਈ ਫੁੱਲਾਂ ਵਾਲ਼ੀ ਚੀਜ਼ ਹੈ ਉਹਦੇ ਵਿੱਚ ਪ ਮਧੂ ਮੱਖੀਆਂ ਵੀ ਆ ਕੇ ਆ ਜਾਂਦੀਆਂ ਨੇ ਫਿਰ ਉਸ ਵੇਲੇ ਅਸੀਂ ਸ਼ਾਮ ਦੇ ਟਾਇਮ ਜਦੋਂ ਮੱਖੀਆਂ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੀਆਂ ਹੈ ਕਿ ਉਹਨਾਂ ਨੂੰ ਵੀ ਮਰਿਆ ਮ ਮਰਨ ਤੋਂ ਬਚਾਉਣਾ ਹੈ ਫਿਰ ਉਸ ਸ਼ਾਮ ਦੇ ਵੇਲੇ ਅਸੀਂ ਸਪਰੇਅ ਕਰਕੇ ਕਰਦੇ ਹਾਂ ਜੀ ਅਤੇ ਕਾਫੀ ਇਹਨਾਂ ਨੂੰ ਸ ਸਮ ਪਾਣੀ ਦੀ ਵੀ ਮੌਸਮ ਦੇ ਹਿਸਾਬ ਨਾਲ ਕਾਫੀ ਉੱਚਾ ਵੀ ਇਹਨਾਂ ਨੂੰ ਕਰਨਾ ਪੈਂਦਾ ਹੈ ਢਕਣਾ ਕਰਨਾ ਕਾਫੀ ਸਹੂਲਤਾਂ ਦਾ ਸਾ ਉਹ ਕਰਨੀਆਂ ਪੈਂਦੀਆਂ ਜੀ ਫੇਰ ਬਗੀ ਇਹਨਾਂ ਨੂੰ ਸਬਜ਼ੀਆਂ ਵਗੈਰਾ ਹੋਇਆ ਹੋਰ ਜੀ ਵੇਲਾਂ ਵਗੈਰਾ ਨੂੰ ਵੀ ਥੱਲੇ ਸਰਕੜ ਗਰਮੀਆਂ ਦੇ ਵਿੱਚ ਜਿਵੇਂ ਘੀਆ ਕੱਦੂ ਆਪਣਾ ਤੋਰੀ ਅਤੇ ਖੀਰਾ ਵਗੈਰਾ ਦੀਆਂ ਵੇਲਾਂ ਨੂੰ ਥੱਲੇ ਸਰਕੜਾ ਵਿਛਾ ਕੇ ਉੱਪਰ ਉੱਪਰ ਉਹਨਾਂ ਨੂੰ ਥੱਲੇ ਵਿਛਾ ਕੇ ਸਰਕੜਾ ਕੇ ਥੱਲੇ ਦੀ ਮਿੱਟੀ ਧੁੱਪ ਨਾਲ ਗਰਮ ਹੋਣ ਤੋਂ ਸਰਕੜਾ ਵਿਛਾਇਆ ਹੋਵੇਗਾ ਤਾਂ ਉਹਦੇ ਫਾਇਦੇ ਹੁੰਦੇ ਹਨ ਫਿਰ ਇੱਕ ਉਹਦੇ ਜਿਹੜੇ ਵਾਲ ਜਿਹੇ ਹੁੰਦੇ ਨੇ ਵੇਲਾਂ ਦੇ ਉਹ ਸਰਕੜੇ ਨੂੰ ਅੱਗੇ ਅੱਗੇ ਕੁੰਡਲੀ ਪਾ ਕੇ ਅਤੇ ਵਧਣ ਦੀ ਕੋਸ਼ਿਸ਼ ਕਰਦੀ ਹੈ ਜੀ